ਹਾਂਜੀ ਮੈਂ ਸੁੰਦਰ ਕੁਦਰਤੀ ਸੈਟਿੰਗ ਵਾਲੀ ਜਗ੍ਹਾ ਯਾਨੀ ਕਿ ਬਹੁਤ ਹੀ ਸੁੰਦਰ ਜਗ੍ਹਾ ਸੀਗੀ ਉਹ ਉੱਥੇ ਵੀ ਮੈਂ ਗਿਆ ਹੋਇਆ ਹਾਂ ਇਹ ਜਗ੍ਹਾ ਹੈਗੀ ਹੈ ਫਰੀਦਾਬਾਦ 'ਚ ਹਰਿਆਣੇ 'ਚ ਪੈਂਦਾ ਹੈ ਜਿਹੜਾ ਫਰੀਦਾਬਾਦ ਉੱਥੇ ਹਨ ਅਤੇ ਉੱਥੇ ਹੈਗੀਆਂ ਬਡਖਲ ਝੀਲ ਅਤੇ ਮੈਂ ਉੱਥੇ ਜਿਹੜੀ ਝੀਲ ਦੇ ਵਿੱਚ ਜਾ ਕੇ ਉੱਥੇ ਆਪਣਾ ਬਹੁਤ ਹੀ ਅੱਛੀ ਝੀ ਯਾਤਰਾ ਕੀਤੀ ਅਤੇ ਉੱਥੇ ਪਾਣੀ ਦਾ ਇੱਕ ਕਾਫੀ ਅ ਉਹ ਇਕੱਠਾ ਕ ਕੀਤਾ ਹੋਇਆ ਹੈ ਅਤੇ ਉਹਦੇ ਵਿੱਚ ਨਾਓ ਚਲਾਈਆਂ ਜਾਂਦੀਆਂ ਹਨ ਅਤੇ ਉਹਨਾਂ ਨਾਵਾਂ ਦੇ ਵਿੱਚ ਬੈਠ ਕੇ ਵੀ ਮੈਂ ਉਹ ਨਾਵ ਦੀ ਸੈਰ ਕੀਤੀ ਅਤੇ ਹੋਰ ਵੀ ਮੈਂ ਦੇਖਿਆ ਕਿ ਉੱਥੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਉਹ ਤਾਂ ਤੈਰ ਵੀ ਰਹੇ ਸਨ ਲੇਕਿਨ ਉਹਨਾਂ ਨੇ ਇੱਕ ਵਾੜ੍ਹ ਲਗਾ ਰੱਖੀ ਸੀਗੀ ਕਿ ਉਸ ਤੋਂ ਅੱਗੇ ਉਹ ਬੱਚੇ ਨਾ ਜਾਣ ਤੈਰਨ ਵਾਸਤੇ ਅਤੇ ਉੱਥੇ ਰੈਸਟੋਰੈਂਟ ਵੀ ਸੀਗੇ ਅਹੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਰੈਸਟੋਰੈਂਟ ਦੇ ਅੰਦਰ ਵੀ ਆਪਣਾ ਖਾਣਾ ਪੀਣਾ ਵੀ ਉੱਥੇ ਕੀਤਾ ਅਤੇ ਹੋਰ ਉੱਥੇ ਪਾਰਕ ਵੀ ਬਹੁਤ ਅੱਛੇ ਬਣੇ ਹੋਏ ਸੀ ਪਹਾੜ ਹੈਗੇ ਨੇ ਚਾਰੋ ਪਾਸੇ ਬਹੁਤ ਸੁੰਦਰ ਪਹਾੜ ਲੱਗਦੇ ਨੇ ਉਹ ਕੁਦਰਤ ਵੱਲੋਂ ਇੰਨਾ ਅੱਛਾ ਨਜ਼ਾਰਾ ਬਣਦਾ ਸੀਗਾ ਦੇਖਣ ਨੂੰ ਕਿ ਉਹ ਦੇਖਦਿਆਂ ਹੀ ਆਪਣੇ ਦਿਲ ਨੂੰ ਮੋਹ ਲੈਂਦਾ ਸੀਗਾ ਐਸੀ ਸੁੰਦਰ ਜਗ੍ਹਾ ਦੇ ਉੱਤੇ ਜਾ ਕੇ ਮਨ ਨੂੰ ਬਹੁਤ ਹੀ ਤਸੱਲੀ ਮਿਲੀ ਅਤੇ ਮੋਹ ਬਹੁਤ ਹੀ ਚੰਗਾ ਲੱਗਿਆ ਅਹ ਉੱਥੇ ਉਹ ਜਿਹੜਾ ਪਾਣੀ ਉੱਥੇ ਇਕੱਠਾ ਹੋਇਆ ਹੈ ਹੁੰਦਾ ਹੈ ਝੀਲ ਦੇ ਵਿੱਚ ਉਹ ਜਿਹੜਾ ਪਾਣੀ ਇਕੱਠਾ ਹੈ ਉਹ ਕੁਦਰਤ ਵੱਲੋਂ ਹੀ ਹੋਇਆ ਹੁੰਦਾ ਹੈ ਜਦੋਂ ਬਾਰਿਸ਼ ਹੁੰਦੀ ਹੈ ਤਾਂ ਉਹ ਪਹਾੜਾਂ ਦੇ ਵਿੱਚ ਹੋਣ ਕਰਕੇ ਉੱਥੇ ਇੱਕ ਛੋਟਾ ਜਿਹਾ ਤਲਾਬ ਵਾਂਗੂ ਬਣ ਜਾਂਦਾ ਹੈ ਝੀਲ ਬਣ ਜਾਂਦੀ ਹੈ ਅਤੇ ਉਹਦੇ ਵਿੱਚ ਹੀ ਉਹ ਸਾਰਾ ਪਾਣੀ ਇਕੱਠਾ ਰਹਿੰਦਾ ਹੈ ਅਤੇ ਉਹਦੇ ਆਲੇ ਦੁਆਲੇ ਇੱਕ ਪਾਰਕਿੰਗ ਵਾਂਗੂ ਜਗ੍ਹਾ ਬਣਾ ਰੱਖੀ ਹੈ ਗੌਵਰਮੈਂਟ ਨੇ ਜਿਹੜੀ ਸਰਕਾਰ ਨੇ ਜਿੱਥੇ ਆ ਕੇ ਉਹ ਸਾਰੇ ਲੋਕ ਉੱਥੇ ਉਸ ਦਾ ਆਨੰਦ ਲੈਂਦੇ ਹਨ